ਕੰਮ ਦੇ ਨਾਲ ਨਾਲ ਆਪਣੇ ਮਨ ਨੂੰ ਬਦਲਣ ਲਈ ਯੋਗ ਇੱਕ ਬਹੁਤ ਹੀ ਲਾਹੇਵੰਦ ਅਤੇ ਸਰੀਰ ਦੀਆਂ ਕਾਫ਼ੀ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਇੱਕ ਵਧੀਆ ਵਿਚਾਰ ਹੈ ਤੁਸੀਂ ਧਿਆਨ ਦਿੰਦੇ ਹੋ ਕਿ ਤੁਹਾਡਾ ਮਨ ਕਿਸ ਪਾਸੇ ਘੁੰਮਦਾ ਹੈ ਜਿਸ ਨੂੰ ਆਪਾਂ ਬਦਲਣ ਵਾਸਤੇ ਯੋਗ ਦੀ ਸਹਾਇਤਾ ਲੈ ਸਕਦੇ ਹਾਂ ਅਤੇ ਯੋਗ ਦੇ ਕਾਰਨ ਅਸੀਂ ਜੋ ਵੀ ਦਿਮਾਗੀ ਸਮੱਸਿਆਵਾਂ ਹੈ ਉਸਨੂੰ ਠੀਕ ਕਰ ਸਕਦੇ ਹਾਂ ਲਗਭਗ ਯੋਗ ਦਾ ਸਮੇਂ ਸਵੇਰ ਦਾ ਹੋਣਾ ਚਾਹੀਦਾ ਹੈ